ਮੌਸਮ ਪਹਾੜ ਦੀ ਚੜ੍ਹਾਈ ਵਿੱ ਨੂੰ ਕਾਫ਼ੀ ਜਿਆਦਾ ਪ੍ਰਭਾਵਿਤ ਕਰਦਾ ਹੈ ਜਿਵੇਂ ਦਾ ਮੌਸਮ ਹੋਊਂਗਾ ਸਾਨੂੰ ਉਵੇਂ ਦੀ ਤਿਆਰੀ ਖਿੱਚਣੀ ਪੈਣੀ ਹੈ ਅਤੇ ਅਗਰ ਤਾਂ ਮੌਸਮ ਸਾਫ਼ ਸੁਥਰਾ ਹੁੰਦਾ ਹੈ ਤੇ ਧੁੱਪ ਵਾਲਾ ਮੌਸਮ ਹੈ ਵਧੀਆ ਮੌਸਮ ਹੁੰਦਾ ਅਤੇ ਉਹਦੇ ਵਿੱਚ ਸਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਹੈਗੀ ਕੋਈ ਮੀਂਹ ਨਹੀਂ ਪੈਂਦਾ ਅਤੇ ਆਪਾਂ ਅਰਾਮ ਨਾਲ ਆਪਣਾ ਅਰਾਮ ਨਾਲ ਆਪਣੀ ਚੜ੍ਹਾਈ ਚੜ੍ਹ ਸਕਦੇ ਹਾਂ ਅਤੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਅਗਰ ਮੌਸਮ ਥੋੜ੍ਹਾ ਖ਼ਰਾਬ ਹੁੰਦਾ ਹੈ ਮੀਂਹ ਪੈਣਾ ਸਟਾਟ ਹੋ ਜਾਂਦਾ ਹੈ ਜਾਂ ਕੋਈ ਬਰਫਬਾਰੀ ਵੀ ਹੋ ਜਾਂਦੀ ਹੈ ਤਾਂ ਸਾਨੂੰ ਕਾਫ਼ੀ ਜਿਆਦਾ ਮਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ ਜਿਵੇਂ ਪਹਾੜ ਉੱਤੇ ਪਹਿਲਾਂ ਹੀ ਚੜ੍ਹਾਈ ਹੁੰਦੀ ਹੈ ਕਾਫ਼ੀ ਜਿਆਦਾ ਅਤੇ ਉੱਪਰੋਂ ਫਿਸਲਣ ਹੋ ਜਾਣੀ ਹੈ ਅਤੇ ਸਾਡਾ ਪੈਰ ਸਲਿੱਪ ਕਰੂੰਗਾ ਅਸੀਂ ਗਿਰ ਵੀ ਸਕਦੇ ਹਾਂ ਅਤੇ ਇੱਕ ਇੱਕ ਤਾਂ ਪਹਿਲੀ ਹੀ ਬੜੀ ਜ਼ਿਆਦਾ ਤਿੱਖੀ ਚੜ੍ਹਾਈ ਹੁੰਦੀ ਹੈ ਉੱਥੇ ਤੁਰਨਾ ਹੀ ਵੈਸੇ ਹੀ ਮੁਸ਼ਕਲ ਹੁੰਦਾ ਹੈ ਉੱਪਰੋਂ ਜਦੋਂ ਮੀਂਹ ਪੈ ਜਾਂਦਾ ਹੈ ਤਾਂ ਉੱਥੇ ਚਿੱਕੜ ਹੋ ਜਾਂਦਾ ਹੈ ਅਤੇ ਉੱਥੇ ਫਿਸਲਣ ਕਾਫ਼ੀ ਜਿਆਦਾ ਵੱਧ ਜਾਂਦੀ ਹੈ ਬੰਦੇ ਦੇ ਫਿਸਲਣ ਦੇ ਕਾਫ਼ੀ ਜ਼ਿਆਦਾ ਹੀ ਚਾਂਸ ਵੱਧ ਜਾਂਦੇ ਹੈ ਅਤੇ ਅਗਰ ਆਪਾਂ ਇੱਦਾਂ ਦੇ ਮੌਸਮ ਵਿੱਚ ਚੜ੍ਹਾਈ ਚੜ੍ਹਾਂਗੇ ਤਾਂ ਸਾਡੇ ਸੱਟ ਚੋਟ ਲੱਗਣ ਦੀ ਵੀ ਸੰਭਾਵਨਾ ਹੁੰਦੀ ਹੈ ਅਤੇ ਕਾਫ਼ੀ ਜ਼ਿਆਦਾ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ ਅਤੇ ਇਸ ਕਰਕੇ ਖ਼ਰਾਬ ਮੌਸਮ ਵਿੱਚ ਚੜ੍ਹਾਈ ਨਾ ਚੜ੍ਹਨਾ ਹੀ ਸਹੀ ਰਹੂੰਗਾ ਮੇਰੇ ਲਈ ਮੈਂ ਤਾਂ ਇਹੀ ਸੋਚੂੰਗਾ ਕਿ ਅਗਰ ਖ਼ਰਾਬ ਮੌਸਮ ਹੋਵੇ ਤਾਂ ਥੋੜ੍ਹਾ ਟਾਈਮ ਰੁਕ ਕੇ ਮੌਸਮ ਸਾਫ਼ ਹੋਣ ਦੀ ਮੈਨੂੰ ਵੇਟ ਕਰਨੀ ਚਾਹੀਦੀ ਹੈ